ਰੂਪਨਗਰ ਜ਼ਿਲ੍ਹੇ ਵਿੱਚ ਮਨੋਰੰਜਨ ਗਤੀਵਿਧੀਆਂ ਬਹੁਤ ਜ਼ਿਆਦਾ ਹਨ ਜਿਵੇਂ ਕਿ ਸਾਡੇ ਰੂਪਨਗਰ ਜ਼ਿਲ੍ਹੇ ਵਿੱਚ ਹੋਲਾ ਮਹੱਲਾ ਸਾਡੇ ਭੱਠਾ ਸਾਹਿਬ ਹੁੰਦਾ ਹੈ ਜੀ ਇਸ ਦੇ ਨਾਲ ਨਾਲ ਸਾਡੇ ਮਹਾਰਾਜ ਮਹਾਰਾਜਾ ਰਣਜੀਤ ਸਿੰਘ ਪਾਰਕ ਹੈ ਜਿੱਥੇ ਕਿ ਕੋਈ ਟਿਕਟ ਕੋਈ ਕੋਈ ਐਕਸਟਰਾ ਫੇਅਰ ਨ ਕੋਈ ਜ਼ਿਆਦਾ ਪੈਸੇ ਨਹੀਂ ਦੇਣੇ ਪੈਂਦੇ ਸਭ ਫਰੀ ਹਨ ਇਸੇ ਨਾਲ ਨਾਲ ਸਾਡੇ ਵੇਰਕਾ ਬੂਥ ਬਣਾਇਆ ਹੋਇਆ ਹੈ ਜੀ ਔਰ ਵੌਟ ਕਲੱਬ ਬਣਿਆ ਹੋਇਆ ਹੈ ਬਹੁਤ ਵਧੀਆ ਮਨੋਰੰਜਕ ਸਾਧਨ ਹਨ ਅਤੇ ਬਹੁਤ ਵਧੀਆ ਇੱਥੇ ਹਰਿਆਲੀ ਹਰੇ ਭਰੇ ਮੈਦਾਨ ਹਨ ਔਰ ਮਿਲਦੇ ਹਨ ਜਿਸਦੇ ਨਾਲ ਸਾਡੇ ਬੱਚਿਆਂ ਨੂੰ ਗੇ ਖੇਲਣ ਵਾਸਤੇ ਗੇਮਾਂ ਵਾਸਤੇ ਸਾਡਾ ਨਹਿਰੂ ਸਟੇਡੀਅਮ ਬਹੁਤ ਵਧੀਆ ਬਣਿਆ ਹੋਇਆ ਹੈ ਜਿਸ ਵਿੱਚ ਬਹੁਤ ਜ਼ਿਆਦਾ ਟਰੇਡ ਫੇਅਰ ਮੇਲੇ ਬਹੁਤ ਜ਼ਿਆਦਾ ਹੁੰਦੇ ਹਨ ਔਰ ਜਿਸਦਾ ਆਨੰਦ ਸਾਡੇ ਰੌਪੜ ਸ਼ਹਿਰ ਦੇ ਵਾਸੀ ਔਰ ਨਾਲ ਦੇ ਪਿੰਡਾਂ ਦੇ ਵਾਸੀ ਲੈਂਦੇ ਹਨ